ਹਾਂ ਇੱਕ ਵਧੀਆ ਪੋਟਰੇਟ ਉਹ ਹੀ ਪੋਰਟਰੇਟ ਹੈ ਜੋ ਨੈਚੁਰਲ ਢੰਗ ਨਾਲ ਮਨਾਇਆ ਜਾਵੇ ਅਤੇ ਉਹ ਇੱਕ ਵਧੀਆ ਪੋਰਟਰੇਟ ਕਹਿਲਾਉਂਦਾ ਹੈ ਜਿਸ ਤਰ੍ਹਾਂ ਜਿਸ ਵਿੱਚ ਜਿਸ ਵਿੱਚ ਉਹ ਪੋਰਟਰੇਟ ਇੱਦਾਂ ਦਾ ਬਣਾਓ ਜਿਸ ਵਿੱਚ ਉਹਦੀ ਸੱਚਾਈ ਅਸਲੀਅਤ ਨਜ਼ਰ ਆਵੇ ਜਿੱਦਾਂ ਕਿਵੇਂ ਪਾਰਕ ਵਿੱਚ ਦੋ ਬੱਚੇ ਖੇਲ ਰਹੇ ਹਨ ਉਹਨਾਂ ਦਾ ਪੋਰਟਰੇਟ ਬਣਾ ਲਓ ਉਹ ਬੱਚੇ ਉਹ ਦਰਸਾਉਂਦੇ ਹੈ ਕਿ ਬੱਚਾ ਦੇਖੋ ਬਚਪਨ ਕਿੰਨਾ ਮਸੂਮੀ ਮਸੂਮ ਹੁੰਦਾ ਹੈ ਦੋ ਮੀਆਂ ਬੀਬੀ ਦੋ ਬੁੱਢਾ ਜੋੜਾ ਸੈਰ ਕਰਦਾ ਪਿਆ ਅਤੇ ਉਹ ਦਰਸ਼ਾਉਂਦਾ ਹੈ ਕਿ ਸਾਨੂੰ ਦੇਖੋ ਬੁਢਾਪੇ 'ਚ ਵੀ ਸਾਨੂੰ ਇੱਕ ਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਇੱਕ ਦੂਜੇ ਦਾ ਸਹਾਰਾ ਬਣ ਕੇ ਰਹਿਣਾ ਚਾਹੀਦਾ ਹੈ ਅਤੇ ਜੋ ਜਿਵੇਂ ਕੋਈ ਯੋਗਾ ਕਰ ਰਿਹਾ ਹੈ ਯੋਗਾ ਕਰਦਾ ਇਹ ਉਹ ਦਰਸਾਉਂਦਾ ਹੈ ਕਿ ਸਾਨੂੰ ਯੋਗਾ ਕਰਨ ਸਾਡੀ ਸਿਹਤ ਕਿੰਨੀ ਫਿਟ ਰਹਿੰਦੀ ਹੈ ਅਤੇ ਅਸੀਂ ਫਿਟ ਰਹਿੰਦੇ ਹਾਂ ਤਾਂ ਇਹ ਇੱਦਾਂ ਦੇ ਪੋਰਟਰੇਟ ਬਣਾਉਣੇ ਚਾਹੀਦੇ ਵੀ ਜਿਸ ਤਰ੍ਹਾਂ ਉਹ ਇਹਨਾਂ ਨੂੰ ਵੀ ਚਾਪਲੂਸੀ ਕਰਨ ਦੀ ਕੋਈ ਲੋੜ ਹੀ ਨਹੀਂ ਹੁੰਦੀ ਹੈਗੀ ਇਹ ਇੱਕ ਤਰ੍ਹਾਂ ਦਾ ਨੈਚੁਰਲ ਢੰਗ ਨਾਲ ਢੰਗ ਦਾ ਆ ਜਾਂਦਾ ਇਹ ਅਸਲੀਅਤ ਪ੍ਰਗਟ ਕਰਦਾ ਹੈ ਇਹਦੇ ਨਾਲ ਅਸਲੀਅਤ ਨੂੰ ਦਰਸਾਉਂਦਾ ਇਹ ਅਤੇ ਇਹ ਇੱਦਾਂ ਦੀ ਪੋਰਟਰੇਟ ਸਭ ਨੂੰ ਪਸੰਦ ਆਉਂਦੇ ਜਿਹੜੇ ਜਿਹਨਾਂ ਵਿੱਚ ਨੈਚੁਰਲੀ ਹੁੰਦੀ ਹੈ ਜਿਹਨਾਂ ਵਿੱਚ ਅਸਲੀਅਤ ਹੁੰਦੀ ਹੈ ਵੀ ਹਾਂ ਮਨ ਨੂੰ ਲੱਗਦੇ ਹੈ ਇੱਦਾਂ ਦੇ ਪੋਰਟਰੇਟ ਬਣਾਉਣੇ ਚਾਹੀਦੇ ਹਨ ਅਤੇ ਉਹ ਸਭ ਨੂੰ ਪਸੰਦ ਆਉਂਦੇ ਨੇ